ਅੱਜ ਦੇ ਟਾਈਮ ਵਿੱਚ ਮੋਟਰਸਾਈਕਲ ਬਹੁਤ ਜਰੂਰੀ ਸਾਰੀ ਦੁਨੀਆ ਮੋਟਰਸਾਇਕਲ ਵਰਤਦੀ ਆ ਆਉਣਾ ਜਾਣਾ ਬਾਜ਼ਾਰ 'ਚ ਘਰਦਿਆਂ ਨੂੰ ਲੈ ਕੇ ਬਾਜ਼ਾਰ ਜਾਣਾ ਕੋਈ ਲੀੜਾ ਕੱਪੜਾ ਸੌਦਾ ਪੱਤਾ ਦਵਾ ਕੇ ਲਿਆਉਣਾ ਕਿਤੇ ਰਿਸ਼ਤੇਦਾਰੀ ਚ ਦੂਰ ਜਾਣਾ ਹੁੰਦਾ ਮੋਟਰਸਾਈਲ ਦੇ ਨਾਲ ਸਮਾਂ ਬਚਦਾ ਇਹਦੇ ਨਾਲ ਜਲਦੀ ਤੋਂ ਜਲਦੀ ਬੰਦਾ ਆਪਦੇ ਟਿਕਾਣੇ ਤੇ ਪਹੁੰਚ ਜਾਂਦਾ ਆ ਕਿਉਂ ਦਸ ਪੰਦਰਾ ਸਾਲ ਤੋਂ ਮੈਂ ਮੋਟਰਸਾਈਕਲ ਯੂਜ ਕਰਦਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਇੱਕ ਤਾਂ ਟਾਈਮ ਨਹੀਂ ਲੱਗਦਾ ਛੇਤੀ ਬੰਦਾ ਪਹੁੰਚ ਜਾਂਦਾ ਦੂਜੀ ਗੱਲ ਇਹ ਵੀ ਕੁਛ ਵੀ ਸਮਾਨ ਲਿਆਉਣਾ ਲਿਉਣਾ ਹੁੰਦਾ ਮਿੰਟੋ ਮਿੰਟੀ ਚਲ ਜਾਂਦਾ ਬੰਦਾ ਕੋਈ ਰਸ਼ਕੇ ਦਾ ਕੋਈ ਇੰਤਜ਼ਾਰ ਨਹੀਂ ਕਰਦਾ ਵੀ ਮੈਨੂੰ ਇਸ ਕਰਕੇ ਮੈਂ ਸਲੰਡਰ ਭਰਾ ਕੇ ਲਿਆਉਦਾ ਬਾਜ਼ਾਰ ਕੱਪੜੇ ਕੁ ਲੀੜੇ ਘਰਦਿਆ ਨੂੰ ਦੁਆ ਕੇ ਲਿਆਉਨਾ ਆ ਬਾਕੀ ਬਹੁਤ ਹੀ ਚੰਗਾ ਲੱਗਦਾ ਮੈਨੂੰ ਮੋ